ਪੰਜਾਬ ਦਾ ਸੱਭਿਆਚਾਰ ਦੂਜੇ ਦੇਸ਼ਾਂ ਨਾਲ਼ੋਂ ਇਸ ਕਰਕੇ ਵੱਖਰਾ ਹੈ ਕਿਉਂਕਿ ਅੱਜ ਵੀ ਲੋਕ ਇੱਥੇ ਆਪਣੇ ਸੱਭਿਆਚਾਰ ਨਾਲ਼ ਜੁੜੇ ਹੋਏ ਹਨ ਅੱਜ ਦੇ ਸਮੇਂ ਵਿੱਚ ਪੰਜਾਬੀ ਸੱਭਿਆਚਾਰ ਪੰਜਾਬ ਵਿੱਚ ਹੀ ਨਹੀਂ ਸਗੋਂ ਦੇਸਾਂ ਵਿਦੇਸਾਂ ਵਿੱਚ ਮਸ਼ਹੂਰ ਹੈ ਹੋਰ ਦੇਸ਼ਾਂ ਦੇ ਲੋਕ ਵੀ ਪੰਜਾਬੀ ਸੱਭਿਆਚਾਰ ਨੂੰ ਬਹੁਤ ਪਸੰਦ ਕਰਦੇ ਹਨ ਜਿਵੇਂ ਪੰਜਾਬੀ ਲੋਕ ਗੀਤ ਪੰਜਾਬੀ ਰਵਾਇਤੀ ਪਹਿਰਾਵਾ ਆਦਿ ਇਹ ਸਭ ਸੱਭਿਆ ਤਰੀਕੇ ਇਸ ਨੂੰ ਸੱਭਿਆਚਾਰ ਨਾਲੋਂ ਵੱਖ ਕਰਦਾ ਹੈ